ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ ਇਸੇ ਲਈ ਸਾਡੀ ਜਿਹੜੀ ਨੌਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਪੈ ਗਈ ਹੈ ਨਾ ਹੀ ਲੋੜੀ ਦੀਆਂ ਸਹੂਲਤਾਂ ਉਪਲਬਧ ਨੇ ਨਾ ਸਰਕਾਰ ਨਾ ਸਮਾਜ ਨਾ ਸਕੂਲ ਕੋਈ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖਰੇ ਵੱਖਰੇ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ ਕਿਉਂਕਿ ਇਹ ਬੇਹੱਦ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਪਾਇਆ ਜਾਵੇ ਖੇਡਣ ਨਾਲ ਉਹਨਾਂ ਦੇ ਮਨ ਅਤੇ ਸਰੀਰ ਦੋਵਾਂ ਦਾ ਵਿਕਾਸ ਹੋਣਾ ਅਤੇ ਜੇ ਨੌਜਵਾਨਾਂ ਦਾ ਵਿਕਾਸ ਹੋਵੇਗਾ ਤਾਂ ਆਪਣੇ ਆਪ ਹੀ ਸਮਾਜ ਦਾ ਵਿਕਾਸ ਹੋਵੇਗਾ ਅਤੇ ਨਸ਼ੇ ਤੋਂ ਉਹ ਮੁਕਤ ਰਹਿਣਗੇ ਸੋ ਸਾਡੀ ਸਰਕਾਰ ਨੂੰ ਸਾਡੇ ਸਮਾਜ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ